ਹੈਲੋ ਹੈਲੋ ਹੈਲੋ ਹਾਂਜੀ ਕੌਣ ਸਰ ਹਾਂਜੀ ਹਾਂਜੀ ਬੋਲੋ ਸਰ ਹਾਂਜੀ ਹਾਂਜੀ ਕਰਿਆਨੇ ਦੀ ਗਰੋਸਰੀ ਦਾ ਸਾਰਾ ਸਮਾਨ ਹੀ ਹੁੰਦਾ ਜੀ ਆਪਣੇ ਕੋਲ ਅੱਛਾ ਜੀ ਆਜੋ ਜੀ ਜਦੋ ਮਰਜੀ ਆਪਣੇ ਕੋਲ ਮਿਲ ਜਾੂਗਾ ਜੀ ਸਾਰਾ ਸਮਾਨ ਗਰੋਸਰੀ ਜੋ ਵੀ ਆਪਣੇ ਹਲਵਾਈ ਦੀ ਕੋਈ ਹੈ ਰਿਕੁਆਇਰਮੈਂਟ ਜੋ ਵੀ ਸਾਰਾ ਸਮਾਨ ਮਿਲਜੂ ਜੀ ਹਾਂਜੀ ਹਾਂਜੀ ਜੀ ਹਾਂਜੀ ਹਾਂਜੀ ਹਾਂਜੀ ਖੰਡ ਗੁੜ ਸਾਰਾ ਕੁਛ ਮਿਲ ਜਾਂਦਾ ਜੀ ਮੈਦਾ ਬੇਸਣ ਚਾਵਲ ਮਸਾਲੇ ਚਾਹ ਪੱਤੀ ਜੋ ਵੀ ਚੀਜ਼ ਦੀ ਚਾਹੀਦੀ ਆ ਥੋਨੂੰ ਸਾਰੀ ਚੀਜ਼ ਮਿਲਜੂ ਜੀ ਹਾਂਜੀ ਜੀ ਚਾਵਲ ਆਪਣੇ ਕੋਲ ਮਿਲ ਜਾਣਗੇ ਜੀ ਲਾਲ ਕਿਲਾ ਮਿਲ ਜਾਊਗਾ ਜੀ ਇੰਡੀਆ ਗੇਟ ਮਿਲ ਜਾਊਗਾ ਸੰਜੀਵਨੀ ਮਿਲ ਜਾਊਗਾ ਇਹ ਸਾਰੇ ਬਾਸਮਤੀ ਚਾਵਲ ਆਉਂਦੇ ਆ ਜੀ ਵਧੀਆ ਲੰਮੇ ਬਣਦੇ ਆ ਆ ਇਹ ਜੁੜਦੇ ਨਹੀਂ ਹੈਗੇ ਤੇ ਇਕੱਲਾ ਇਕੱਲਾ ਚਾਵਲ ਬਣਦਾ ਜੀ ਇਹ ਵਧੀਆ ਕੁਆਲਿਟੀ ਦੇ ਇੰਡੀਆ ਗੇਟ ਵੀ ਆ ਲਾਲ ਕਿਲਾ ਜਾ ਸੰਜੀਵਨੀ ਇਹ ਕੁਆਲਿਟੀਆਂ ਆਪਣੇ ਕੋਲੇ ਹੈਗੀਆਂ ਵਧੀਆ ਚ ਬਾਕੀ ਖੁੱਲੇ ਵੀ ਆਉਂਦੇ ਨੇ ਉਹ ਵੀ ਮਿਲ ਜਾਣਗੇ ਜਿਸ ਤਰ੍ਹਾਂ ਤੁਹਾਨੂੰ ਪਸੰਦ ਆਉਣਗੇ ਉਸ ਤਰੀਕੇ ਨਾਲ ਕਿੰਨੇ ਕ ਚਾਹੀਦੇ ਚਾਵਲ ਹਾਂ ਮਿਲ ਜਾਣਗੇ ਜੀ ਇਹ ਜਿਹੜੇ ਆਪਣੇ ਇੰਡੀਆ ਗੇਟ ਦੇ ਪੰਜ ਪੰਜ ਕਿਲੋ ਦੀਆਂ ਥੈਲੀਆਂ ਹੁੰਦੀਆਂ ਜੀ ਪੈਕਿੰਗ ਹਾਂਜੀ ਜਿੰਨੀਆਂ ਤੁਸੀਂ ਕਹੋਗੇ ਆਪਾਂ ਦੇ ਦਾਂਗੇ ਜੀ ਸਭ ਤੋਂ ਵਧੀਆ ਕੁਆਲਿਟੀ ਹੋਊਗੀ ਅੱਛਾ ਜੀ ਅੱਛਾ ਨਾ ਨਾ ਕੋਈ ਨੀ ਜੀ ਜਿੰਨਾ ਤੁਸੀਂ ਕਹੋਗੇ ਦੇ ਦਾਂਗੇ ਜੀ ਹਾਂਜੀ ਨਹੀਂ ਨਹੀਂ ਐਮ ਡੀ ਐੱਚ ਮਿਲ ਦੇਵਾਂਗੇ ਜੀ ਬਿਲਕੁਲ ਐਮ ਡੀ ਐੱਚ ਚੀਜ਼ ਚੱਲਦੇ ਹਲਵਾਈ ਲਿਖਦੇ ਈ ਐਮ ਡੀ ਐੱਚ ਆ ਜੀ ਤੇ ਉਹਦੇ ਚ ਤੁਹਾਨੂੰ ਕਮਿਸ਼ਨ ਵੀ ਘੱਟ ਦਿਆਂਗੇ ਕੁਛ ਦਸ ਪ੍ਰਸੈਂਟ ਛੋਟ ਦੇ ਕੇ ਤੁਹਾਨੂੰ ਐਮ ਡੀ ਐੱਚ ਦਾ ਜੋ ਵੀ ਪ੍ਰਿੰਟ ਹੁੰਦਾ ਐਮ ਆਰ ਪੀ ਉਹਦੇ ਚੋ ਦਸ ਪ੍ਰਸੈਂਟ ਦੀ ਤੁਹਾਨੂੰ ਛੋਟ ਦੇ ਹਾਂ ਡਿਸਪੋਜਲ ਮਿਲ ਜਾਣਗੇ ਜੀ ਡਿਸਪੋਜਲ ਜਿਸ ਤਰ੍ਹਾਂ ਦਾ ਤੁਸੀਂ ਕਹੋਗੇ ਮਿਲ ਜਾਏਗਾ ਤੇ ਹਾਂ ਡਿਸਪੋਜਲ ਕੋਲਡਰਿੰਕ ਵੀ ਖੀਰ ਵਾਸਤੇ ਕੱਚੇ ਚਾਵਲ ਹੁੰਦੇ ਆ ਜੀ ਹਾਂ ਹਾਂ ਜੀ ਜਿਹੜੇ ਜੀ ਹਾਂ ਉਹ ਤਾਂ ਬਾਸਮਤੀ ਹੁੰਦੇ ਆ ਜੀ ਜਿਹੜੇ ਖੀਰ ਵਾਲੇ ਹੁੰਦੇ ਉਹ ਕੱਚੇ ਚਾਵਲ ਹੁੰਦੇ ਆ ਜੀ ਉਹ ਲੂਜ ਮਿਲਣਗੇ ਜਿੰਨੇ ਤੁਸੀਂ ਕਹੋਗੇ ਖੁੱਲੇ ਮਿਲ ਜਾਣਗੇ ਜੀ ਹਾਂ ਉਹ ਥੋੜੇ ਟੁੱਟ ਹੁੰਦੀ ਨਾ ਵਿੱਚ ਫਿਰ ਖੀਰ ਵਾਲੇ ਉਹ ਬਣਦੇ ਆ ਜੀ ਹਾਂਜੀ ਹਾਂਜੀ ਹਾਂਜੀ ਹਾਂ ਜਦੋਂ ਮਰਜ਼ੀ ਆ ਜਾਓ ਜੀ ਜੋ ਵੀ ਲਿਸਟ ਚ ਤੁਹਾਡਾ ਸਮਾਨ ਹੋਇਆ ਸਾਰਾ ਸਮਾਨ ਤੁਹਾਡਾ ਪੂਰਾ ਕਰਕੇ ਦੇਵਾਂਗੇ ਠੀਕ ਐ ਹਾਂਜੀ ਓਕੇ